ਸਤਿ ਸ਼੍ਰੀ ਅਕਾਲ ਜੀ ਗਗਨ ਸਵੀਟਸ ਤੋਂ ਬੋਲ ਰਹੇ ਹੋ ਹਾਂ ਮੈਂ ਗੁਰਪ੍ਰੀਤ ਬੋਲ ਰਿਹਾ ਕੱਲ੍ਹ ਤੁਹਾਨੂੰ ਔਡਰ ਦੇ ਕੇ ਗਿਆ ਸੀ ਹਾਂਜੀ ਅ ਪਾਰਟੀ ਦਾ ਪਾਰਟੀ ਸੀ ਨਾ ਤਾਂ ਉਹਦਾ ਔਡਰ ਦੇ ਕੇ ਗਿਆ ਸੀ ਮੈਂ ਤੁਹਾਨੂੰ ਕੁਛ ਐਡਵਾਂਸ ਵੀ ਦੇ ਕੇ ਗਿਆ ਸੀ ਹਾਂਜੀ ਔਡਰ ਦੇ ਵਿੱਚ ਅਸਨੈਕਸ ਕੁਛ ਲਿਖਵਾਏ ਸੀ ਅਤੇ ਨਾਲ ਮੇਨ ਕੋਰਸ ਦੇ ਲਿਖਾ ਕੇ ਗਿਆ ਸੀ ਹਾਂਜੀ ਹਾਂਜੀ ਮੇਨ ਕੋਰਸ ਦੇ ਵਿੱਚ ਅ ਦੋ ਸਬਜ਼ੀਆਂ ਸੀ ਪਨੀਰ ਦੀ ਸੀ ਮਿਕਸ ਸਬਜ਼ੀ ਸੀ ਰਾਈਸ ਸੀ ਨਾਲ ਨਾਨ ਸੀ ਹਾਂਜੀ ਹਾਂਜੀ ਕਿਸੇ ਕਾਰਨ ਕਰਕੇ ਨਾ ਉਹ ਪ੍ਰੋਗਰਾਮ ਕੈਂਸਲ ਹੋ ਗਿਆ ਅਤੇ ਪ੍ਰੋਗਰਾਮ ਨਹੀਂ ਹੋ ਸਕਦਾ ਅਤੇ ਇਸ ਲਈ ਮੈਂ ਉਹ ਔਡਰ ਵੀ ਕੈਂਸਲ ਕਰਵਾਉਣਾ ਸੀ ਹਾਂਜੀ ਉਹ ਮੈਂ ਕਹਿਣਾ ਚਾਹੁੰਦਾ ਸੀ ਉਹ ਤੁਹਾਨੂੰ ਪੈਸੇ ਦਿੱਤੇ ਸੀ ਨਾ ਐਡਵਾਂਸ ਕੁਛ ਤਾਂ ਉਹ ਪਲੀਜ਼ ਫਿਰ ਵਾਪਸ ਕਰ ਦਿਓ ਕਿਉਂਕਿ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਹੀ ਦੱਸ ਰਿਹਾ ਹਾਂ ਵੀ ਪ੍ਰੋਗਰਾਮ ਕੈਂਸਲ ਹੈ ਅਤੇ ਮੈਨੂੰ ਹੁਣ ਉਹ ਨਹੀਂ ਕੁਛ ਵੀ ਚਾਹੀਦਾ ਸਮਾਨ ਹਾਂਜੀ ਤੁਸੀਂ ਇਸ ਤਰ੍ਹਾਂ ਕਰੋ ਪੈਸੇ ਮੇਰੇ ਗੂਗਲ ਜਿਹੜਾ ਪੇਅ ਹੈਗਾ ਉੱਧਰ ਕਰ ਦਿਉ ਜਾਂ ਫਿਰ ਜੇ ਕੈਸ਼ ਦੇਣੇ ਤਾਂ ਕੈਸ਼ ਦੇ ਦਿਉ ਕਿਉਂਕਿ ਤੁਹਾਡੀ ਅਜੇ ਉਹ ਸਾਰੀ ਲਾਗਤ ਤਾਂ ਲੱਗੀ ਨਹੀਂ ਹੈ ਹਾਂਜੀ ਸਾਡੇ ਪੁਰਾਣੇ ਮਤਲਬ ਰਿਲੇਸ਼ਨਜ਼ ਨੇ ਸਾਰੇ ਔਡਰ ਅਸੀਂ ਤੁਹਾਨੂੰ ਹੀ ਦੇਈ ਦੇ ਨੇ ਹਾਂਜੀ ਠੀਕ ਹੈ ਚਲੋ ਕੱਲ੍ਹ ਆ ਕੇ ਲੈ ਜਾਵਾਂ ਪੈਸੇ ਬਾਕੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ